ਪੰਜਾਬ ਵਿੱਚ ਕਲਾ ਅਤੇ ਸ਼ਿਲਪਕਾਰੀ ਵੱਖ ਵੱਖ ਪਹਿਲ ਕਦਮੀਆਂ ਰਾਹੀਂ ਸਥਾਨਕ ਭਾਈਚਾਰੇ ਨੂੰ ਸ਼ਾਮਿਲ ਕਰਨ ਅਤੇ ਸਮਰਥਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਡਿਜ਼ਾਇਨਰ ਅਕਸਰ ਰਵਾਇਤੀ ਸ਼ਿਲਪਕਾਰਾਂ ਨੂੰ ਆਧੁਨਿਕ ਬਣਾਉਣ ਲਈ ਦਖਲ ਦਿੰਦੇ ਹੈ ਉਹਨਾਂ ਦੀ ਅਪੀਲ ਨੂੰ ਵਧਾਉਂਦੇ ਹੈ ਅਤੇ ਗਲੋਬਲ ਮਾਰਕੀਟ ਵਿੱਚ ਉਹਨਾਂ ਦੀ ਸਾਰਥਿਕਤਾ ਨੂੰ ਯਕੀਨੀ ਬਣਾਉਂਦੇ ਹੈ ਇਹ ਦਖਲ ਅੰਦਾਜ਼ੀ ਸਥਾਨਕ ਕਾਰੀਗਰਾਂ ਨੂੰ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ ਜਿਸ ਨਾਲ ਉਹਨਾਂ ਦੀ ਕਾਰੀਗਰੀ ਲਈ ਵਿਸ਼ਵ ਪੱਧਰੀ ਪ੍ਰਸ਼ੰਸਾ ਹੁੰਦੀ ਹੈ ਅਜਿਹੀ ਪ੍ਰਸ਼ੰਸਾ ਨਾ ਸਿਰਫ ਸਥਾਨਕ ਮਾਣ ਵਧਾਉਂਦੀ ਹੈ ਸਗੋਂ ਨਵੇਂ ਨਵੇਂ ਆਰਥਿਕ ਮੌਕੇ ਵੀ ਪੈਦਾ ਕਰਦੀ ਹੈ ਇਸ ਤੋਂ ਇਲਾਵਾ ਸਹਿਕਾਰੀ ਅਤੇ ਅਪ੍ਰੈਂਟਿਸ ਪ੍ਰੋਗਰਾਮ ਹੁਨਰਾਂ ਨੂੰ ਸੁਰੱਖਿਅਤ ਰੱਖਣ ਅਤੇ ਪਾਸ ਕਰਨ ਲਈ ਸਹਾਈ ਹੁੰਦੀ ਹੈ ਇਹ ਪ੍ਰੋਗਰਾਮ ਨੌਜਵਾਨ ਕਾਰੀਗਰਾਂ ਨੂੰ ਹੱਥੀਂ ਸਿਖਲਾਈ ਪ੍ਰਦਾਨ ਕਰਦੇ ਹੈ ਰਵਾਇਤੀ ਤਕਨੀਕਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਂਦੇ ਹੋਏ ਨਵੀਨਤਾ ਨੂੰ ਉਤਸ਼ਾਹਿਤ ਕਰਦੇ ਹੈ ਇਹਨਾਂ ਯਤਨਾਂ ਰਾਹੀਂ ਪੰਜਾਬ ਦਾ ਕਲਾ ਅਤੇ ਸ਼ਿਲਪ ਖੇਤਰ ਸਥਾਨਕ ਅਰਥਚਾਰਿਆਂ ਨੂੰ ਮਜ਼ਬੂਤ ਕਰਦਾ ਹੈ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਦਾ ਹੈ ਅਤੇ ਹੁਨਰਮੰਦ ਕਾਰੀਗਰਾਂ ਦੀ ਰੋਜ਼ੀ ਰੋਟੀ ਦਾ ਸਮਰਥਨ ਕਰਦਾ ਹੈ ਇੱਕ ਜੀਵੰਤ ਅਤੇ ਟਿਕਾਊ ਸ਼ਿਲਪਕਾਰੀ ਭਾਈਚਾਰੇ ਦੀ ਸਿਰਜਣਾ ਕਰਦਾ ਹੈ